ਪੰਜਾਬ ਦੇ ਪ੍ਰਸ਼ਾਸਨ ਵੱਲੋਂ ਸਿਹਤ ਸੰਭਾਲ ਉੱਤੇ ਬਹੁਤ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇੱਥੇ ਬਹੁਤ ਜਨਸੰਖਿਆ ਹੈ ਅਤੇ ਲੋਕਾਂ ਦੀ ਸਿਹਤ ਸੰਭਾਲ ਕਰਨਾ ਪ੍ਰਸ਼ਾਸਨ ਦਾ ਫਰਜ਼ ਹੈ ਇੱਥੇ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲ ਛੋਟੇ ਜਾਂਚ ਕੇਂਦਰ ਖੋਲ੍ਹੇ ਹੋਏ ਹਨ ਪ੍ਰਾਈਵੇਟ ਸੈਕਟਰ ਵਿੱਚ ਵੀ ਬਹੁਤ ਸਾਰੇ ਅਦਾਰੇ ਖੁੱਲ੍ਹੇ ਹੋਏ ਹਨ ਹਰ ਤਰ੍ਹਾਂ ਦਾ ਇਲਾਜ ਅੱਜ ਦੇ ਸਮੇਂ ਦੀ ਟੈਕਨੋਲਜੀ ਨਾਲ ਕੀਤਾ ਜਾਂਦਾ ਹੈ ਜਿਵੇਂ ਐਕਸਰੇ ਮਸ਼ੀਨਾਂ ਈ ਸੀ ਜੀ ਮਸ਼ੀਨਾਂ ਵੈਂਟੀਲੇਟਰ ਆਦਿ ਇਨ੍ਹਾਂ ਸਹੂਲਤਾਂ ਲਈ ਪ੍ਰਸ਼ਾਸਨ ਨੇ ਬਹੁਤ ਪੈਸਾ ਖ਼ਰਚ ਕੀਤਾ ਹੋਇਆ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਦਾ ਰ ਇਲ ਇਲਾਜ ਹੋ ਸਕੇ ਪ੍ਰੋਜੈਕਟਾਂ ਰਾਹੀਂ ਇਲਾਕੇ ਇਲਾਕੇ ਵਿੱਚ ਸੈਮੀਨਾਰ ਲਾਏ ਜਾਂਦੇ ਹਨ ਸਿਹਤ ਸੰਭਾਲ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ ਟੈਕਨੋਲਜੀ ਦਾ ਸਿਹਤ ਖੇਤਰ ਵਿੱਚ ਬਹੁਤ ਬੜਾ ਯੋਗਦਾਨ ਹੈ ਇਸ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ ਲੋਕਾਂ ਨੂੰ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ